ਮੇਰੇ ਕੋਲ ਕੋਈ ਵੀ ਅਨੁਭਵ ਨਹੀਂ ਹੈ ਪਰ ਮੈਂ ਕੁਝ ਸਧਾਰਨ ਗੱਲਾਂ ਦੱਸ ਸਕਦੀ ਹਾਂ ਜਿਨਾਂ ਤੋਂ ਪਤਾ ਲੱਗ ਸਕਦਾ ਹੈ ਕਿ ਕਿਸੇ ਦਾ ਸੋਸ਼ਲ ਮੀਡੀਆ ਅਕਾਊਂਟ ਹੈਂਗ ਹੋਇਆ ਹੈ ਪਹਿਲਾ ਪਾਸਵਰਡ ਵਿੱਚ ਬਦਲਾ ਜੇ ਕਿਸੇ ਨੂੰ ਆਪਣੇ ਅਕਾਊਂਟ ਵਿੱਚ ਪਾਸਵਰਡ ਬਦਲਿਆ ਹੈ ਅਤੇ ਉਸਦਾ ਖੁਦ ਇਸ ਨੂੰ ਨਹੀਂ ਪਤਾ ਤਾਂ ਇਹ ਹੈਂਗ ਹੁੰਦਾ ਇੱਕ ਸਪਸ਼ਟ ਇੰਡੀਕੇਟਰ ਹੋ ਸਕਦਾ ਹੈ ਜਾਨੇ ਪਹਿਚਾਨੇ ਨਾ ਤੋਂ ਅਜੇ ਪੋਸਟਾਂ ਜਾਂ ਸਟੇਟਸ ਜੇ ਕੋਈ ਹੈਕਰ ਕਿਸੇ ਦੇ ਅਕਾਊਂਟ ਦਾ ਅਮਲ ਕਰਦਾ ਹੈ ਯੂਜ ਕਰਦਾ ਹੈ ਤਾਂ ਉਹ ਅਜੀਬ ਜਾਂ ਅਨਜਾਨ ਪੋਸਟਾਂ ਸਟੇਟਸ ਜਾਂ ਮੈਸਜਾ ਆ ਪਾ ਸਕਦਾ ਹੈ ਸੋਸ਼ਲ ਮੀਡੀਆ ਐਪਲੀਕੇਸ਼ਨ ਤੋਂ ਲੋਗਿੰਗ ਪ੍ਰਸ਼ਨ ਜੇ ਤੁਸੀਂ ਅਕਾਊਂਟ ਵਿੱਚ ਲੋਗਇਨ ਕਰਨ ਦੀ ਕੋਸ਼ਿਸ਼ ਕਰਦੇ ਹੋ ਪਰ ਇਹ ਨਹੀਂ ਹੋ ਸਕਦਾ ਤਾਂ ਇਹ ਸਦ ਸਦਾ ਦੱਸਦਾ ਹੈ ਕਿ ਤੁਹਾਡਾ ਅਕਾਊਂਟ ਹੈਂਗ ਹੋ ਸਕਦਾ ਹੈ ਜੋ ਕਿਸੇ ਦਾ ਅਕਾਊਂਟ ਹੈਂਗ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਤੇ ਖਾਤੇ ਦਾ ਪਾਸਵਰਡ ਬਦਲਣਾ ਅਤੇ ਪ੍ਰੋਫਾਈਲ ਸੈਟਿੰਗ ਜਾਂ ਈਮੇਲ ਨੂੰ ਸੰਭਾਵ ਸੰਭਾਲਣਾ ਚਾਹੀਦਾ ਹੈ ਫਿਰ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਸੰਪਰਕ ਕਰਕੇ ਇਹਨਾਂ ਨਾਲ ਰਿਪੋਰਟਰ ਕੀਤਾ ਜਾ ਸਕਦਾ ਹੈ